ਪੰਜਾਬ ਵਿੱਚ ਵੱਖ ਵੱਖ ਵਰਗਾਂ ਦੇ ਲੋਕ ਰਹਿੰਦੇ ਹਨ ਜਿਹਨਾਂ ਦੁਆਰਾ ਭਾਸ਼ਾਵਾਂ ਵੀ ਵੱਖ ਵੱਖ ਬੋਲੀਆਂ ਜਾਂਦੀਆਂ ਹਨ ਪਰ ਮੁੱਖ ਤੌਰ 'ਤੇ ਪੰਜਾਬੀ ਦੀ ਵਰਤੋਂ ਜ਼ਿਆਦਾ ਕੀਤੀ ਜਾਂਦੀ ਹੈ ਇਹ ਸਾਡੇ ਸਰਕਾਰੀ ਅਦਾਰਿਆਂ ਅਤੇ ਵਿੱਦਿਅਕ ਸੰਸਥਾਵਾਂ 'ਚ ਵੀ ਵਰਤੀ ਹੀ ਜਾਣ ਵਾਲੀ ਬੋਲੀ ਹੈ ਹੁਣ ਤਾਂ ਪੰਜਾਬੀ ਬੋਲੀ ਬਾਹਰਲੇ ਦੇਸ਼ਾਂ 'ਚ ਵੀ ਲਾਗੂ ਹੋ ਚੁੱਕੀ ਹੈ ਕਿਉਂਕਿ ਇੱਥੇ ਦੀ ਵਸੋਂ ਉੱਥੇ ਜਾ ਕੇ ਵੱਸ ਗਈ ਹੈ ਪੰਜਾਬ ਵਿੱਚ ਸਭ ਤੋਂ ਵੱਧ ਪ੍ਰਭਾਵ ਸਾਡੀ ਬੋਲੀ ਪਾਉਂਦੀ ਹੈ ਕਿਉਂਕਿ ਇਹ ਸਾਡੇ ਰੀਤੀ ਰਿਵਾਜਾਂ ਅਤੇ ਸਾਡੀਆਂ ਬੋਲੀਆਂ ਵੀ ਇਸੇ ਭਾਸ਼ਾ ਵਿੱਚ ਜ਼ਿਆਦਾਤਰ ਪ੍ਰਚਲਿਤ ਹਨ ਪੰਜਾਬੀ ਭਾਸ਼ਾ ਦਾ ਸਾਡੇ ਨਿੱਜੀ ਜੀਵਨ 'ਤੇ ਡੂੰਘਾ ਪ੍ਰਭਾਵ ਹੈ ਇਹ ਬਹੁਤ ਹੀ ਖੁੱਲ੍ਹ ਦਿਲੀ ਵਾਲੀ ਭਾਸ਼ਾ ਹੈ ਇਸ ਦੇ ਪੈਂਤਰੀ ਪੈਂਤੀ ਅੱਖਰ ਹਨ ਅਤੇ ਇਹ ਇਹਨਾਂ ਸ ਰਾਹੀਂ ਅਸੀਂ ਆਪਣੇ ਨਿੱਜੀ ਅਤੇ ਦਿਲੀ ਤੌਰ ਤਰੀਕਿਆਂ ਰਾਹੀਂ ਆਪਣੇ ਵਿਚਾਰਾਂ ਦਾ ਪ੍ਰਦਰਸ਼ਨ ਕਰ ਸਕਦੇ ਹਾਂ ਪੰਜਾਬ ਦੀ ਭਾਸ਼ਾ ਦਾ ਸਾਡੇ ਜੀਵਨ 'ਤੇ ਡੂੰਘਾ ਪ੍ਰਭਾਵ ਹੈ ਇਹ ਸਾਡੇ ਰਾਜ ਦੇ ਵਿਭਿੰਨ ਸੱਭਿਆਚਾਰਕ ਪ੍ਰਭਾਵਾਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ਼ ਦਰਸਾਉਂਦੀ ਹੈ